ਜੇ ਕੋਈ ਵਿਅਕਤੀ ਨਵਾਂ ਤੈਰਨਾ ਤੈਰਨ ਮਾਰਨਾ ਸਿੱਖ ਰਿਹਾ ਤਾਂ ਉਸਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਕੀ ਡੂੰਘੇ ਪਾਣੀ ਵਿੱਚ ਨਹੀਂ ਜਾਣਾ ਚਾਹੀਦਾ ਹੈ ਅਤੇ ਅਗ ਹੈਂ ਦਲ ਦਲ ਵਿੱਚ ਵੀ ਉਸ ਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਉਸ ਨਾਲ ਇੱਕ ਜ਼ਰੂਰ ਹੀ ਬੰਦਾ ਹੋਣਾ ਚਾਹੀਦਾ ਹੈ ਜੋ ਕਿ ਉਸਨੂੰ ਤੈਰਦੇ ਸਮੇਂ ਨਾਲ ਹੋਵੇ ਅਤੇ ਉਸਨੂੰ ਇੱਕ ਆਪਣੇ ਨਾਲ ਟਰੱਕ ਜਾਂ ਮੋ ਕਿਸੇ ਵੀ ਸਾਧਨ ਦੀ ਟੂਪ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਡੁੱਬ ਨਾ ਸਕੇ ਇਸ ਕਰਕੇ ਉਸਨੂੰ ਬਹੁਤ ਸਾਰੀ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਅਤੇ ਜੇ ਤੈਰੀ ਸਿੱਖਣੀ ਹੋਵੇ ਤਾਂ ਘੱਟ ਪਾਣੀ ਵਿੱਚ ਸਿੱਖ ਸਕਦਾ ਹੈ ਡੂੰਘੇ ਪਾਣੀ ਵਿੱਚ ਜਾਣ ਦੀ ਲੋੜ ਨਹੀਂ ਉਸਨੂੰ ਇਸ ਕਰਕੇ ਉਹ ਤੈਰੀ ਸਿੱਖ ਸਕਦਾ ਹੈ